ਹੈਲੋ ਹਾਂਜੀ ਹਾਂਜੀ ਤੁਸੀਂ ਕੌਣ ਅੱਛਾ ਹਾਂਜੀ ਹਾਂਜੀ ਬਿਲਕੁਲ ਹਾਂਜੀ ਬਿਲਕੁਲ ਸਾਡੇ ਅੰਮ੍ਰਿਤਸਰ 'ਚ ਤਾਂ ਬਥੇਰੇ ਹੈਗੇ ਆ ਤੁਸੀਂ ਪਹਿਲਾਂ ਜਿੱਦਾਂ ਕਿ ਕੰਪਨੀ ਗਾਰਡਨ ਹੈਗਾ ਅੰਗਰੇਜ਼ਾਂ ਨੇ ਇੱਥੇ ਬਣਾਇਆ ਸੀਗਾ ਉੱਥੇ ਤੁਸੀਂ ਜਾ ਸਕਦੇ ਹੋ ਮਾਲ ਰੋਡ ਅਤੇ ਉਸ ਪਾਸੇ ਹੀ ਹੈਗਾ ਹੈ ਇੱਥੋਂ ਤੁਸੀਂ ਸਟੇਸ਼ਨ ਤੋਂ ਜੇ ਓਟੋ ਕਰੋਗੇ ਉੱਥੇ ਕਹੋਗੇ ਕਿ ਕੰਪਨੀ ਗਾਰਡਨ ਜਾਣਾ ਹੈਗਾ ਉੱਥੇ ਸਿੱਧਾ ਤੁਹਾਨੂੰ ਮਿਲ ਜਾਏਗਾ ਅਤੇ ਤੁਸੀਂ ਮੈਟਰੋ ਲੈ ਸਕਦੇ ਹੋ ਅਲੈਗਜੈਡਰਾਂ ਤੱਕ ਅਲੈਗਜੈਡਰਾਂ ਤੋਂ ਸਿੱਧਾ ਪੈਦਲ ਪੈਦਲ ਦੂਰੀ 'ਤੇ ਹੈਗਾ ਮੋਲ ਰੋਡ ਹਾਂਜੀ ਉੱਥੇ ਹਾਂਜੀ ਰੋਜ਼ ਗਾਰਡਨ ਹੈਗਾ ਇੱਥੇ ਤੁਸੀਂ ਉੱਥੇ ਸਭ ਤੋਂ ਵਧੀਆ ਤਾਂ ਸਾਡਾ ਵੈਸੇ ਆਹੀ ਵਾਲਾ ਹੈਗਾ ਕੰਪਨੀ ਗਾਰਡਨ ਉੱਥੇ ਤੁਹਾਨੂੰ ਜ਼ੂ ਵੀ ਹੈਗੇ ਉਹਦੇ ਵਿੱਚ ਕਈ ਸਾਰੇ ਐਕਸਰਸਾਈਜ ਕਰਨ ਲੀਏ ਬਹੁਤ ਸਾਰੇ ਐਕਸਰਸਾਈਜ਼ ਕਰਨ ਲਈ ਹੈਗੀ ਆ ਉੱਥੇ ਜੋ ਵੀ ਤੁਸੀਂ ਕਰ ਸਕਦੇ ਹੋ ਜਿੰਮ ਵਗੈਰਾ ਉਹਨਾਂ ਨੇ ਅੰਦਰ ਬਣਾਇਆ ਹੋਇਆ ਉੱਥੇ ਕਈ ਲੋਕ ਸੈਰ ਕਰਨ ਆਉਂਦੇ ਆ ਬਥੇਰੇ ਤਰੀਕੇ ਦੇ ਉਹਨਾਂ ਨੇ ਪੇੜ ਪੌਦੇ ਉਹਨਾਂ ਦੇ ਬਾਰੇ ਦੱਸਿਆ ਹੋਇਆ ਹੈ ਸਿੱਧਾ ਕਹੋ ਕੰਪਨੀ ਗਾਰਡਨ ਜਾਣਾ ਹੈਗਾ ਉਹ ਤੁਹਾਨੂੰ ਕੰਪਨੀ ਗਾਰਡਨ ਲੈ ਜਾਉਗੇ ਮਾਲ ਰੋਡ ਦੀ ਤਰਫ ਹੈਗਾ ਜੀ ਹਾਂਜੀ ਥੈਂਕ ਯੂ